ਮਹਾਂਵਾਰੀ ਦੌਰਾਨ ਮਾਂਹਵਰੀ ਦੌਰਾਨ ਜਾਗਰੂਕਤਾ ਸਵੱਛਤਾ ਅਤੇ ਸਿਹਤ ਬਾਰੇ ਜਾਗਰੂਕਤਾ ਦੀ ਜ਼ਰੂਰਤ ਤਾਂ ਹੈ ਹੀ ਹੈ ਪਹਿਲਾਂ ਕਿਆ ਹੁੰਦਾ ਸੀਗਾ ਅੱਜ ਕੱਲ੍ਹ ਤਾਂ ਸਾਧਨ ਹੀ ਬਹੁਤ ਹੋ ਗਏ ਪਹਿਲਾਂ ਹੁੰਦਾ ਸੀਗਾ ਜਦੋਂ ਕਿਸੇ ਲੇਡੀਜ਼ ਨੂੰ ਮਾਂਹਵਾਰੀ ਆ ਜਾਣੀ ਤਾਂ ਉਸਨੇ ਆਪਣੇ ਘਰ ਦੇ ਵਿੱਚ ਕੋਈ ਫਟਿਆ ਪੁਰਾਣੇ ਕੱਪੜੇ ਖੱਦਰ ਦੇ ਜਾਂ ਜਾਂ ਕੋਈ ਮੋਟਾ ਕੱਪੜਾ ਲੱਭਣਾ ਉਹ ਆਪਣੇ ਉਸ ਸਥਾਨ 'ਤੇ ਲਗਾਉਂਦੇ ਸੀਗੇ ਜਿੱਥੇ ਦੀ ਮਾਂਹਵਾਰੀ ਦਾ ਆਉਣ ਜਾਣ ਹੁੰਦਾ ਸੀਗਾ ਪਰ ਅੱਜ ਕੱਲ੍ਹ ਤਾਂ ਸਾਧਨ ਹੀ ਬਹੁਤ ਆ ਗਏ ਆ ਸਟੇਅ ਫ੍ਰੀ ਫਲਾਣਾ ਟੀ ਆਹਾ ਜੀ ਆਹਾ ਜੀ ਡਾਕਟਰਾਂ ਦੀ ਦੁਕਾਨਾਂ ਤੋਂ ਮਿਲਦੇ ਆ ਉਹ ਲੈ ਕੇ ਆਪਣੀ ਲਗਾ ਲੈਂਦੇ ਆ ਜਿਸ ਨਾਲ਼ ਆਪਣੇ ਸਵੱਛਤਾ ਮਹਿਸੂਸ ਕਰਦੇ ਨੇ ਓਕੇ